ਮੈਂ ਰਾਜ ਕੁਮਾਰ ਜਿਲਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਜਿਵੇਂ ਕੀ ਆਵਾਜਾਈ ਦੀ ਘਾਟ ਦਾ ਕਿਵੇਂ ਪ੍ਰਵਾਹਿਤ ਹੁੰਨੇ ਹਾਂ ਜਿਵੇਂ ਕੀ ਆਵਾਜਾਈ ਅੱਜ ਦੇ ਯੁੱਗ ਵਿੱਚ ਬਸ ਟਰੱਕ ਕਾਰ ਅਤੇ ਬਾਈਕ ਹਨ ਸਾਨੂੰ ਆਵਾਜਾਈ ਤੋਂ ਬਹੁਤ ਸਹੂਲਤਾਂ ਮਿਲਦੀਆਂ ਹਨ ਪਰ ਆਵਾਜ਼ਾਈ ਤੋਂ ਪ੍ਰਭਾਵਿਤ ਉਸ ਟਾਈਮ ਹੁੰਦੇ ਹਾਂ ਜਿਵੇਂ ਕੀ ਕੋਈ ਮਰੀਜ਼ ਹਸਪਤਾਲ ਵਿੱਚ ਲੈ ਕੇ ਜਾ ਰਹੀ ਐਬੂਲੈਂਸ ਹੁੰਦੀ ਹੈ ਤਾਂ ਅੱਗੇ ਜਿਵੇਂ ਕੀ ਜਾਮ ਲੱਗਾ ਹੁੰਦਾ ਹੈ ਪਰ ਸਭ ਤੋਂ ਪਹਿਲਾਂ ਆਵਾਜਾਈ ਨੂੰ ਥੋੜਾ ਸਾਈਡ ਤੇ ਕਰਕੇ ਐਂਬੂਲੈਂਸ ਨੂੰ ਰਸਤਾ ਦੇਣਾ ਚਾਹੀਦਾ ਹੈ ਪਰ ਜੇਕਰ ਹੋਸਪਿਟਲ ਸ਼ਹਿਰ ਤੋਂ ਬਾਹਰ ਹੋਵੇ ਤਾਂ ਮੈਂ ਬਹੁਤ ਹੀ ਵਧੀਆ ਹੋਵੇਗਾ ਤਾਂ ਮਰੀਜ਼ ਨੂੰ ਹੋਸਪਿਟਲ ਲੈ ਕੇ ਜਾਣ ਵੇਲੇ ਸਮਾਂ ਨਹੀ ਲੱਗੇਗਾ ਸਾਡਾ ਕਾਫੀ ਟਾਈਮ ਵੀ ਬਚੇਗਾ ਅਤੇ ਮਰੀਜ਼ ਵੀ ਸਮੇਂ ਸਿਰ ਹੋਸਪਿਟਲ ਪਹੁੰਚ ਜਾਵੇਗਾ ਇਸ ਕਰਕੇ ਸਹਿਰ ਤੋਂ ਬਾਹਰ ਹੀ ਹੋਸਪਿਟਲ ਹੋਣਾ ਚਾਹੀਦਾ ਹੈ ਇਸ ਤੋਂ ਅਸੀਂ ਆਵਾਜਾਈ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਾਂ